ਜਿੱਥੇ ਮੋਬਾਈਲ ਦੇ ਫਾਇਦੇ ਨੇ ਉੱਥੇ ਉਹਦੇ ਨੁਕਸਾਨ ਵੀ ਨੇ ਜਿਵੇਂ ਹਰ ਚੀਜ਼ ਦੇ ਫਾਇਦੇ ਵੀ ਹੁੰਦੇ ਨੇ ਨੁਕਸਾਨ ਵੀ ਹੁੰਦੇ ਨੇ ਉਸੇ ਤਰ੍ਹਾਂ ਮੋਬਾਇਲ ਦੇ ਵੀ ਹਨ ਮੋਬਾਈਲ ਦੇ ਫਾਇਦੇ ਘੱਟ ਨੇ ਨੁਕਸਾਨ ਜ਼ਿਆਦਾ ਨੇ ਫਾਇਦੇ ਅਸੀਂ ਕਿਸੇ ਨੂੰ ਫੋਨ ਕਰ ਸਕਦੇ ਹਾਂ ਕੁਝ ਵੀਡੀਓਜ਼ ਸ਼ੇਅਰ ਕਰ ਸਕਦੇ ਹਾਂ ਕਿਸੇ ਨਾਲ ਗੱਲਬਾਤ ਕਰ ਸਕਦੇ ਪਰ ਜੇਕਰ ਇਹਦੇ ਨੁਕਸਾਨ ਦੇਖੀਏ ਤਾਂ ਉਹਨਾ ਦੀ ਲਿਸਟ ਫਾਇਦਿਆਂ ਤੋਂ ਬਹੁਤ ਲੰ ਬਹੁਤ ਜ਼ਿਆਦਾ ਵੱਡੀ ਹੈ ਇਹ ਸਿਹਤ ਲਈ ਵੀ ਬੜੇ ਹਾਨੀਕਾਰਕ ਨੇ ਅੱਜ ਕੱਲ੍ਹ ਅੱਧੇ ਤੋਂ ਜ਼ਿਆਦਾ ਲੋਕਾਂ ਦੇ ਐਨਕਾਂ ਲੱਗੀਆਂ ਹੋਈਆਂ ਨੇ ਅਤੇ ਉਹਨਾਂ ਦਾ ਸਭ ਤੋਂ ਵੱਡਾ ਕਾਰਨ ਮੋਬਾਈਲ ਫੋਨ ਲੋਕ ਸਾਰਾ ਦਿਨ ਆਪਣੇ ਕਮਰਿਆਂ 'ਚ ਬੈਠ ਕੇ ਮੋਬਾਇਲ ਫੋਨ ਚਲਾਉਂਦੇ ਰਹਿੰਦੇ ਨੇ ਸਾਡੇ ਕੋਲ ਕਿਸੇ ਨਾਲ ਗੱਲਬਾਤ ਕਰਨ ਦਾ ਸਮਾਂ ਹੀ ਹੈ ਨਹੀਂ ਕਿਉਂਕਿ ਸਾਡਾ ਸਾਰਾ ਸਮਾਂ ਸਾਡੇ ਮੋਬਾਇਲ ਫੋਨਾਂ ਨੇ ਲੈ ਲਿਆ ਅਸੀਂ ਆਪਣੇ ਯਾਰਾਂ ਦੋਸਤਾਂ ਨਾਲ ਆਪਣੇ ਘਰ ਦਿਆਂ ਨਾਲ ਬੈਠ ਕੇ ਗੱਲਬਾਤ ਨਹੀਂ ਕਰ ਸਕਦੇ ਕਿਉਂਕਿ ਸਾਡੀ ਖਿੱਚ ਸਾਡੇ ਫੋਨ ਨਾਲ ਜ਼ਿਆਦਾ ਹੈ ਅਤੇ ਜੇਕਰ ਫੋਨ ਸਾਡਾ ਕੁਝ ਘੰਟੇ ਲਈ ਬੰਦ ਹੋ ਜਾਵੇ ਤਾਂ ਐਵੇਂ ਲੱਗਦਾ ਕਿ ਸਾਰੀ ਦੁਨੀਆਂ ਰੁੱਕ ਗਈ ਜੋ ਕਿ ਬਹੁਤ ਗਲਤ ਹੈ ਹਰ ਇੱਕ ਚੀਜ਼ ਨੂੰ ਇੱਕ ਲਿਮਿਟ 'ਚ ਵਰਤਣਾ ਚਾਹੀਦਾ ਹੈ ਅਤੇ ਉਹਦਾ ਫਾਇਦੇ ਲੈਣੇ ਚਾਹੀਦੇ ਨੇ ਨਾ ਕਿ ਮੋਬਾਈਲ ਫੋਨ ਦੀ ਤਰ੍ਹਾਂ ਜੇ ਉਹਨੂੰ ਜ਼ਿਆਦਾ ਵਰਤਾਂਗੇ ਤਾਂ ਉਹਦੇ ਨੁਕਸਾਨ ਵਧਣਗੇ ਅਤੇ ਸਾਡੀ ਸਰੀਰਕ ਜਿਹੜੀ ਹੈਲਥ ਹੈ ਉਹ ਵੀ ਖਰਾਬ ਹੋਵੇਗੀ ਨਾਲ ਨਾਲ ਸਾਡੀ ਮਾਨਸਿਕ ਹੈਲਥ ਵੀ ਬਹੁਤ ਜ਼ਿਆਦਾ ਖਰਾਬ ਹੋਵੇਗੀ